ਮੇਰਾ ਬੁਣਾਈ ਦੇ ਵਿੱਚ ਬਹੁਤ ਹੀ ਇੰਟਰੱਸਟ ਆ ਛੋਟੇ ਹੁੰਦਿਆਂ ਤੋਂ ਹੀ ਮੈਂ ਆਪਣੇ ਮੰਮਾ ਅਤੇ ਦਾਦੀ ਜੀ ਨੂੰ ਉਹ ਸਵੈਟਰ ਵਗੈਰਾ ਬੁਣਦਿਆਂ ਦੇਖਦੀ ਹੁੰਦੀ ਸੀ ਅਤੇ ਮੈਂ ਉਹਨਾਂ ਤੋਂ ਇੱਕ ਦਿਨ ਪੁੱਛਿਆ ਕਿ ਮੰਮਾ ਇਹ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਮੈਂ ਇਹ ਸਵੈਟਰ ਬਣਾਉਂਦੀ ਹਾਂ ਅਤੇ ਉਹਨਾਂ ਨੇ ਫਿਰ ਮੈਨੂੰ ਸਿਲਾਈਆਂ ਦਿੱਤੀਆਂ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕਿੱਦਾਂ ਬੁਣਾਈ ਕਰੀ ਦੀ ਆ ਉਹਨਾਂ ਨੇ ਮੈਨੂੰ ਇੱਕ ਇੱਕ ਸਿਲਾਈ ਦਾ ਦੱਸਿਆ ਕਿ ਇਹ ਇੱਦਾਂ ਕਰੀ ਦੇ ਅਤੇ ਇੱਦਾਂ ਅਤੇ ਉਹਨਾਂ ਨੇ ਮੈਨੂੰ ਡਿਫਰੈਂਟ ਡਿਫਰੈਂਟ ਡਿਜ਼ਾਈਨਜ਼ ਵੀ ਬਣਾਉਣੇ ਸਿਖਾਏ ਜਿਹਦੇ ਨਾਲ ਕਿ ਮੇਰਾ ਹੋਰ ਇੰਟਰੱਸਟ ਇਹਦੇ ਵਿੱਚ ਵੱਧ ਗਿਆ ਅਤੇ ਫਿਰ ਮੈਂ ਹੋਰ ਜ਼ਿਆਦਾ ਸਵੈਟਰ ਗੈਰਾ ਬਣਾਉਣੇ ਸਟਾਰਟ ਕਰ ਦਿੱਤੇ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਹੀ ਬਹੁਤ ਅਲੱਗ ਅਲੱਗ ਡਿਜ਼ਾਇਨ ਦੇ ਸਵੈਟਰਜ਼ ਬਣਾ ਕੇ ਦਿੱਤੇ ਜੋ ਕਿ ਉਹਨਾਂ ਨੂੰ ਬਹੁਤ ਹੀ ਪਸੰਦ ਆਏ ਉਹ ਜ਼ਿਆਦਾਤਰ ਉਹੀ ਸਵੈਟਰ ਪਾਉਣਾ ਪਸੰਦ ਕਰਦੇ ਆ ਜੋ ਕਿ ਉਹਨਾਂ ਨੂੰ ਮੈਂ ਬਣਾ ਕੇ ਦਿੱਤੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਮੇਰੇ ਹੱਥ ਦੇ ਡਿਜ਼ਾਇਨਜ਼ ਮੇਰੇ ਹੱਥ ਦੀ ਬੁਣਾਈ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ ਅਤੇ ਜਿਹੜੇ ਹੱਥ ਦੇ ਸਵੈਟਰਸ ਆ ਉਹ ਬਹੁਤ ਹੀ ਵਧੀਆ ਲੱਗਦੇ ਆ ਉਹ ਜ਼ਿਆਦਾਤਰ ਮੇਰੇ ਹੱਥ ਦੇ ਸਵੈਟਰਸ ਹੀ ਪਾਉਣਾ ਪਸੰਦ ਕਰਦੇ ਆ ਅਤੇ ਹੋਰ ਵੀ ਲੋਕਾਂ ਨੇ ਮੇਰੇ ਸਵੈਟਰਜ਼ ਨੂੰ ਬਹੁਤ ਹੀ ਪਸੰਦ ਕੀਤਾ ਅਤੇ ਮੈਨੂੰ ਕਿਹਾ ਕਿ ਸਾਨੂੰ ਵੀ ਇਵੇਂ ਦੇ ਸਵੈਟਰਜ਼ ਬਣਾ ਕੇ ਦੇ